ਹਾਂਜੀ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਅਤੇ ਮਤਲਬ ਲਿਖਤੀ ਭਾਈਚਾਰੇ ਦਾ ਹਿੱਸਾ ਹੋਣਾ ਮੈਨੂੰ ਮਹੱਤਵਪੂਰਨ ਮੈਨੂੰ ਲੱਗਦਾ ਵੀ ਹਾਂ ਇਹ ਬਹੁਤ ਮਹੱਤਵਪੂਰਨ ਹੈ ਵੀ ਮੈਂ ਲਿਖਦੀ ਹਾਂ ਇਹ ਚੀਜ਼ ਮੈਨੂੰ ਵਧੀਆ ਲੱਗਦੀ ਕਿਉਂਕਿ ਦੇਖੋ ਆਪਣਾ ਯੂਥ ਹੈ ਅੱਜ ਕੱਲ੍ਹ ਮਤਲਬ ਕਿ ਇੰਟਰਨੈਟ 'ਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਵੀ ਇੰਟਰਨੈਟ ਕਰਕੇ ਇਹਨਾਂ ਚੀਜ਼ਾਂ ਨੂੰ ਭੁੱਲਦਾ ਜਾ ਰਿਹਾ ਹੈ ਨਾ ਵੀ ਉਹਨਾਂ ਨੂੰ ਲਿਖਣ ਦਾ ਕੋਈ ਸ਼ੌਕ ਨਹੀਂ ਹੈਗਾ ਬਹੁਤ ਜਣਿਆਂ ਨੂੰ ਹੈਗਾ ਵੀ ਹੈ ਇਹਦੇ 'ਚ ਪਰ ਕਿਤੇ ਨਾ ਕਿਤੇ ਜਾ ਕੇ ਕੀ ਹੈ ਕਿ ਯੂਥ ਇਸ ਚੀਜ਼ ਤੋਂ ਮਤਲਬ ਕਹਿੰਦੇ ਆਪਾਂ ਦੂਰ ਹੁੰਦਾ ਜਾ ਰਿਹਾ ਪਰ ਮੈਨੂੰ ਲਿਖਣ ਦਾ ਬਹੁਤ ਸ਼ੌਕ ਹੈ ਇਸ ਲਈ ਮੈਨੂੰ ਸੁਰਜੀਤ ਪਾਤਰ ਜੀ ਉਹਨਾਂ ਦੀਆਂ ਰਚਨਾਵਾਂ ਬਹੁਤ ਪਸੰਦ ਹੈ ਮੈਂ ਮਤਲਬ ਕਿ ਛੋਟੀ ਹੁੰਦੀ ਬਚਪਨ ਤੋਂ ਵੀ ਪੜ੍ਹਦੀ ਹੁੰਦੀ ਸੀ ਅਤੇ ਹੁਣ ਵੀ ਮਤਲਬ ਮੈਂ ਜਦੋਂ ਅਕਸਰ ਫ੍ਰੀ ਹੁੰਦੀ ਹਾਂ ਮੈਨੂੰ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਨਾ ਬਹੁਤ ਪਸੰਦ ਹੈ ਅਤੇ ਮੈਂ ਅਕਸਰ ਉਹਨਾਂ ਨਾਲ ਆਪਣੀਆਂ ਮਤਲਬ ਆਪਣੇ ਜੋ ਮੈਂ ਲਿਖਦੀ ਹੈ ਹੈ ਨਾ ਉਹ ਲਿਖਤਾਂ ਨੂੰ ਬਹੁਤ ਜ਼ਿਆਦਾ ਕੰਪੇਅਰ ਕਰਕੇ ਦੇਖਦੀ ਹਾਂ ਕਿ ਮੈਨੂੰ ਉੱਥੇ ਮੇਰੇ ਵਿੱਚ ਬਹੁਤ ਕਮੀਆਂ ਦਿੱਖਦੀਆਂ ਨੇ ਉਹਨਾਂ ਦੀ ਲਿਖਣੀ ਵਿੱਚ ਇੱਕ ਜਾਦੂ ਜਿਹਾ ਹੈ ਉਹਨਾਂ ਦਾ ਮਤਲਬ ਲਿਖਣ ਦਾ ਜਿਹੜਾ ਤਰੀਕਾ ਹੈ ਉਹ ਮੈਨੂੰ ਸ ਬਹੁਤ ਵਧੀਆ ਲੱਗਦਾ ਇੰਨੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਦੇ ਹਰ ਇੱਕ ਚੀਜ਼ ਨੂੰ ਇੰਨੀ ਵਧੀਆ ਤਰੀਕੇ ਨਾਲ ਲਿਖਦੇ ਨੇ ਕਿ ਮਤਲਬ ਮੈਂ ਤਾਂ ਆਟੋਮੈਟਿਕਲੀ ਉਹਨਾਂ ਵੱਲ ਇੱਕ ਖਿੱਚ ਜਿਹੀ ਬਣ ਜਾਂਦੀ ਹੈ ਨਾ ਵੀ ਮੇਰਾ ਆਟੋਮੈਟਿਕਲੀ ਦਿਲ ਕਰਦਾ ਵੀ ਨਹੀਂ ਮੈਂ ਪੜ੍ਹਨਾ ਹੈ ਨਾ ਉਹਨਾਂ ਦਾ ਮੈਨੂੰ ਤਰੀਕਾ ਬਹੁਤ ਵਧੀਆ ਲੱਗਦਾ ਅਤੇ ਉਹਨਾਂ ਨੇ ਮਤਲਬ ਫਿਰ ਮੈਨੂੰ ਜਦੋਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਦੀ ਹਾਂ ਫਿਰ ਮੈਨੂੰ ਪਤਾ ਚੱਲਦਾ ਹੈ ਨਾ ਵੀ ਮੈਂ ਕਿੱਥੇ ਕਮੀ ਹੈ ਮੇਰੇ ਵਿੱਚ ਮੈਂ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਕਰਦੀ ਹਾਂ ਅਤੇ ਹਮੇਸ਼ਾ ਕਰਦੀ ਰਹੂੰਗੀ ਕਿਉਂਕਿ ਮੈਂ ਇੱਕ ਆਮ ਜਿਹੀ ਕੁੜੀ ਹਾਂ ਹੈ ਨਾ ਵੀ ਮੈਂ ਛੋਟੇ ਵੈਸੇ ਛੋਟੀਆਂ ਛੋਟੀਆਂ ਚੀਜ਼ਾਂ ਲਿਖਦੀ ਰਹਿੰਦੀ ਹਾਂ ਸੁਰਜੀਤ ਪਾਤਰ ਜੀ ਮੇਰੇ ਲਈ ਹਮੇਸ਼ਾ ਪ੍ਰੇਰਨਾਦਾਇਕ ਰਹਿਣਗੇ ਅਤੇ ਉਹ ਮੇਰੇ ਮਤਲਬ ਕਿ ਸਭ ਤੋਂ ਪਸੰਦੀਦਾ ਪੰਜਾਬੀ ਦੇ ਲੇਖਕ ਵੀ ਨੇ ਅਤੇ ਇਸ ਲਈ ਮੈਂ ਉਹਨਾਂ ਦੀ ਮਤਲਬ ਫੈਨ ਵੀ ਹੈਗੀ ਹਾਂ ਅਤੇ ਮੈਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਹੀ ਜ਼ਿਆਦਾ ਪਸੰਦ ਕਰਦੀ ਹਾਂ